ਪੰਜਾਬ ਤਾਂ ਵੈਸੇ ਹੀ ਪਹਿਰਾਵੇ ਤੋਂ ਪਹਿਚਾਣਿਆ ਜਾਂਦਾ ਹੈ ਇਹ ਦੇਖਿਆ ਜਾਂਦਾ ਹੈ ਕਿ ਪਰੰਪਰਾਗਤ ਮੌਕਿਆਂ 'ਤੇ ਨੱਚਦੇ ਸਮੇਂ ਲੋਕ ਵੱਖਰੇ ਵੱਖਰੇ ਪਹਿਰਾਵੇ ਪਾਉਂ ਪਹਿਨਦੇ ਹਨ ਜਿਵੇਂ ਕਿ ਪੰਜਾਬ ਦੇ ਗੱਭਰੂ ਕੁੜਤਾ ਪਜਾਮਾ ਜਾਂ ਕੁੜਤਾ ਚਾਦਰਾ ਪਾ ਕੇ ਬਹੁਤ ਫਕਰ ਮਹਿਸੂਸ ਕਰਦੇ ਹਨ ਅਤੇ ਭੰਗੜਾ ਪ੍ਰਫੋਰਮ ਕਰਨ ਲੱਗੇ ਵੀ ਇਹੀ ਪੁਸ਼ਾਕ ਪਹਿਨਦੇ ਹਨ ਅਤੇ ਡਾਂਸਰਾਂ ਦੁਆਰਾ ਪਹਿਨੇ ਜਾਣ ਵਾਲੇ ਕੱਪੜੇ ਇਹ ਹਨ ਜਿਵੇਂ ਕਿ ਸਲਵਾਰ ਕਮੀਜ਼ ਅਤੇ ਹੋਰ ਇਹ ਰਵਾਇਤੀ ਕੱਪੜੇ ਪੰਜਾਬ ਨੂੰ ਦਰਸਾਉਂਦੇ ਹਨ ਅੱਜ ਦੀ ਡੇਟ ਦੇ ਵਿੱਚ ਕੁੜਤਾ ਪਜਾਮਾ ਕੁੜਤਾ ਚਾਦਰਾ ਸੱਗੀ ਫੁੱਲ ਕੈਂਠਾ ਵਰਗੇ ਅਨੇਕਾਂ ਗਹਿਣਿਆਂ ਅਤੇ ਪਹਿਰਾਵਿਆਂ ਨੇ ਪੂਰੇ ਵਰਲਡ ਵਿੱਚ ਨਾਂ ਬਣਾ ਦਿੱਤਾ ਹੈ ਜਦੋਂ ਫੋਰਨ ਤੋਂ ਵੀ ਟੂਰਿਸਟ ਇੰਡੀਆ ਵਿੱਚ ਹੁੰਦੇ ਹਨ ਤਾਂ ਉਹਨਾਂ ਨੂੰ ਇਹ ਸ਼ੌਂਕ ਹੁੰਦਾ ਹੈ ਕਿ ਉਹ ਪੱਗ ਸਜਾ ਕੇ ਦੇਖਣ ਜਿਵੇਂ ਕਿ ਸਾਨੂੰ ਪਤਾ ਹੀ ਹੈ ਕਿ ਸਿੱਧੂ ਮੂਸੇਵਾਲੇ ਨੇ ਪੱਗ ਨੂੰ ਬਹੁਤ ਹੀ ਵੱਡੇ ਲੈਵਲ 'ਤੇ ਰੀਪ੍ਰਜੈਂਟ ਕੀਤਾ ਹੈ ਉਹ ਵੀ ਵਰਲਡ ਵਾਈਡ ਸੋ ਇਸ ਤਰ੍ਹਾਂ ਪੂਰੇ ਵਰਲਡ 'ਚ ਹੀ ਪੰਜਾਬ ਨੂੰ ਬਹੁਤ ਜ਼ਿਆਦਾ ਫੇਮਸ ਕਰ ਦਿੱਤਾ ਹੈ ਹਰ ਕੋਈ ਪੰਜਾਬ ਨੂੰ ਵੇਖ ਕੇ ਅਟਰੈਕਟ ਹੁੰਦਾ ਹੈ ਅਤੇ ਜਦੋਂ ਕੋਈ ਸ਼ਰਧਾਲੂ ਜਾਂ ਟੂਰਿਸਟ ਇੰਡੀਆ ਵਿੱਚ ਆਉਂਦਾ ਹੈ ਜਾਂ ਪੰਜਾਬ ਵਿੱਚ ਆਉਂਦਾ ਹੈ ਤਾਂ ਉਹਨੂੰ ਇਹ ਹੁੰਦਾ ਹੈ ਕਿ ਅਸੀਂ ਪੰਜਾਬ ਦੀ ਵੈਸਟਰਨ ਕਲਚਰ ਨੂੰ ਇੱਕ ਵਾਰੀ ਜ਼ਰੂਰ ਪਹਿਣ ਕੇ ਦੇਖੀਏ ਉਹ ਪਾ ਕੇ ਬਹੁਤ ਜ਼ਿਆਦਾ ਫਕਰ ਮਹਿਸੂਸ ਕਰਦੇ ਹਨ ਅਤੇ ਪ੍ਰਸੰਨ ਹੁੰਦੇ ਹਨ ਸੋ ਇਸ ਤਰ੍ਹਾਂ ਦੇ ਗਹਿਣੇ ਜਿਵੇਂ ਕਿ ਸੱਗੀ ਫੁੱਲ ਕੈਂਠਾ ਨੈਕਲੇਸ ਇਹ ਕਾਫੀ ਸਾਰੇ ਪੰਜਾਬ ਦੇ ਗਹਿਣੇ ਹਨ ਜਿਹੜੇ ਕਿ ਪੰਜਾਬ ਨੂੰ ਹੋਰ ਨਿਹਾਰ ਅਤੇ ਸ਼ਿੰਗਾਰ ਲਾਉਂਦੇ ਹਨ